ਜਿਵੇਂ ਕਿ ਮੇਰੀ ਰੁਚੀ ਰਹੀ ਹੈ ਸ਼ੁਰੂ ਤੋਂ ਡਰਾਇੰਗ ਦੀ ਮੈਂ ਡਰਾਇੰਗ ਕਰਦਾ ਹੁੰਦਾ ਸੀ ਘਰ ਦੇ ਵਿੱਚ ਹੈ ਨਾ ਸਕੂਲ ਤੋਂ ਆ ਕੇ ਸਭ ਤੋਂ ਪਹਿਲਾਂ ਮੈਂ ਡਰਾਇੰਗ ਹੀ ਚੱਕਦਾ ਸੀਗਾ ਅਤੇ ਮੇਰੀ ਰੁਚੀ ਬਾਰੇ ਮੇਰੇ ਮਾਪਿਆਂ ਨੂੰ ਪਤਾ ਸੀਗਾ ਬਟ ਫਿਰ ਵੀ ਰੋਕਦੇ ਸੀਗੇ ਉਹ ਵੀ ਡਰਾਇੰਗ ਨਾ ਕਰ ਪੜ੍ਹਲਾ ਭਈ ਅਤੇ ਇੱਕ ਵਾਰ ਇਸ ਤਰ੍ਹਾਂ ਹੀ ਨਾ ਸਾਡੇ ਕੋਈ ਕੰਪਟੀਸ਼ਨ ਆਇਆ ਇੱਥੇ ਰੈਡ ਕਰੋਸ ਵਾਲਿਆਂ ਨੇ ਕਰਾਇਆ ਸੀ ਕੰਪਟੀਸ਼ਨ ਅਤੇ ਮੈਂ ਤਾਂ ਜਾ ਨਹੀਂ ਰਿਹਾ ਸੀ ਮੈਂ ਕਿਹਾ ਮੈਨੂੰ ਕਿਹੜਾ ਡਰਾਇੰਗ ਇੰਨੀ ਚੰਗੀ ਆਉਂਦੀ ਆ ਵੀ ਮੈਂ ਨਹੀਂ ਜਾਣਾ ਹੈਗਾ ਅਤੇ ਉਹ ਘਰਦਿਆਂ ਨੇ ਧੱਕੇ ਨਾਲ ਉੱਥੇ ਭੇਜ ਤਾ ਮੈਨੂੰ ਕਹਿੰਦੇ ਜਾਓ ਉੱਥੇ ਪਾਰਟੀਸਪੇਟ ਕਰੋ ਚੱਲ ਨਹੀਂ ਵੀ ਪ੍ਰਾਈਜ ਉਹ ਕੋਈ ਚੱਕਰ ਨਹੀਂ ਇੱਕ ਵਾਰ ਜ਼ਰੂਰ ਜਾ ਕੇ ਆ ਅਤੇ ਉੱਥੇ ਭਾਗ ਲੈ ਜਾ ਕੇ ਅਤੇ ਮੈਂ ਮੱਲੋ ਜੋਰੀ ਗਿਆ ਉੱਥੇ ਚਲੇ ਤਾਂ ਗਏ ਰੰਗ ਰੁੰਗ ਲੈ ਗਏ ਆਪਣੇ ਡਰਾਇੰਗ ਬੋਰਡ ਅਤੇ ਉੱਥੇ ਸਾਨੂੰ ਮਿਲਿਆ ਕਿ ਇੱਕ ਸੀਨਰੀ ਬਣਾਓ ਸੀਨਰੀ ਬਣਾਈ ਅਤੇ ਮੈਨੂੰ ਇਹ ਸੀਗਾ ਕਿ ਇੰਨੇ ਜਾਣੇ ਹੈਗੇ ਇੰਨੇ ਕਾਫੀ ਸੀਗੇ ਉੱਥੇ ਪਾਰਟੀਸਪੈਂਟਸ ਬਹੁਤ ਸੀਗੇ ਵੀ ਕੋਈ ਇਨਾਮ ਆਵੇਗਾ ਅਤੇ ਜਦੋਂ ਇਹ ਇਨਾਮ ਘੋਸ਼ਿਤ ਕੀਤਾ ਅਤੇ ਮੇਰਾ ਤੀਜਾ ਇਨਾਮ ਸੀਗਾ ਉਹਦੇ ਵਿੱਚ ਤਾਂ ਫਿਰ ਉਸ ਤੋਂ ਬਾਅਦ ਮੈਨੂੰ ਉੱਥੇ ਮੌਕੇ 'ਤੇ ਵੀ ਇਨਾਮ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਜਦੋਂ ਮੈਂ ਸਕੂਲ ਗਿਆ ਤਾਂ ਮੈਂ ਸਕੂਲ ਵਾਲਿਆਂ ਨੂੰ ਵੀ ਮੈਨੂੰ ਇਨਾਮ ਦਿੱਤਾ ਅਤੇ ਉਹ ਇਨਾਮ ਬੇ ਮੇਰੇ ਮੰਮੀ ਨੇ ਬੇਬੇ ਕਹਿੰਦਾ ਬੇਬੇ ਨੇ ਸੰਭਾਲ ਕੇ ਰੱਖਤਾ ਵੋਟਰ ਬੋਟਲ ਸੀ ਉਸ ਟਾਈਮ ਅਤੇ ਉਸ ਟਾਈਮ ਬਹੁਤ ਵਧੀਆ ਬੋਟ ਵੋਟਰ ਬੋਟਲ ਸੀਗੀ ਹੈ ਨਾ ਕਿ ਇਨਸੂਲੇਟਡ ਅਤੇ ਉਹਨਾਂ ਨੇ ਸਾਂਭ ਕੇ ਰੱਖਤੀ ਵੀ ਇਹ ਤੂੰ ਬਾਅਦ 'ਚ ਵਰਤੀ ਬਟ ਉਹ ਕਦੇ ਵਰਤੀ ਉਹ ਨਹੀਂ ਗਈ ਉਹ ਇਨਾਮ ਅੰਦਰ ਹੀ ਪਿਆ ਰਹਿ ਗਿਆ ਤੋ ਇਸ ਤਰ੍ਹਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਜਦੋਂ ਮੈਨੂੰ ਇਨਾਮ ਮਿਲਿਆ ਪਹਿਲਾਂ ਬਾਹਰੋਂ ਵੀ ਫਿਰ ਸਕੂਲ ਵੱਲੋਂ ਅਤੇ ਹੁਨਰ ਦੀ ਜਿਹੜੀ ਕਦਰ ਹੋਈ ਮੈਨੂੰ ਬਹੁਤ ਅੱਛਾ ਲੱਗਿਆ